ਮੈਂ ਹਰਪ੍ਰੀਤ ਵਾਟਸ ਆਪਣੀ ਰੇਲ ਯਾਤਰਾ ਦੀ ਟਿਕਟ ਬੁੱਕ ਕਰਾਉਣ ਲਈ ਆਪ ਜੀ ਨਾਲ ਕੁਛ ਪੁੱਛਣਾ ਚਾਹੁੰਦਾ ਹਾਂ ਮੈਂ ਆਪਣੀ ਸਟੇਸ਼ਨ ਮੂਲ ਸਟੇਸ਼ਨ ਫਾਜ਼ਿਲਕਾ ਤੋਂ ਚੰਡੀਗੜ੍ਹ ਦੀ ਟਿਕਟ ਕਰਾਉਣਾ ਚਾਹੁੰਦਾ ਹਾਂ ਜੋ ਕਿ ਸੋਲ੍ਹਾਂ ਅਕਤੂਬਰ ਦੀ ਹੈ ਅਤੇ ਫਸਟ ਅਤੇ ਜਨਰਲ ਕੋਚ ਦੀ ਕਰਾਉਣਾ ਚਾਹੁੰਦਾ ਹਾਂ ਮੇਰੇ ਤੋਂ ਇਹ ਬੁਕਿੰਗ ਨਹੀਂ ਹੋ ਪਾ ਰਹੀ ਸੀ ਅਤੇ ਪੂਰੀ ਜਾਣਕਾਰੀ ਨਹੀਂ ਸੀ ਇਸ ਲਈ ਮੈਂ ਆਪ ਜੀ ਨਾਲ ਸੰਪਰਕ ਕਰ ਰਿਹਾ ਹਾਂ ਮੇਰੀ ਉਪਭੋਗਤਾ ਆਈ ਡੀ ਏ ਬੀ ਸੀ ਡੀ ਵੰਨ ਟੂ ਥਰੀ ਹੈ ਅਤੇ ਇਸਦਾ ਪਾਸਪੋਰਟ ਵੰਨ ਟੂ ਥਰੀ ਫੋਰ ਫਾਈਵ ਹੈ ਅਤੇ ਇਸ ਦੇ ਰਾਹੀਂ ਮੈਂ ਆਪਣੀ ਟਿਕਟ ਦੀ ਯਾਤਰਾ ਦੀ ਬੁਕਿੰਗ ਕਿਵੇਂ ਕਰਾ ਸਕਦਾ ਹਾਂ ਇਸ ਦੀ ਸਹਾਇਤਾ ਲਈ ਆਪ ਜੀ ਨਾਲ ਸੰਪਰਕ ਕਰ ਰਿਹਾ ਹਾਂ ਕਿਰਪਾ ਕਰਕੇ ਮੇਰੀ ਟਿਕਟ ਦੀ ਬੁਕਿੰਗ ਕਰਾਉਣ ਲਈ ਸਹਾਇਤਾ ਕੀਤੀ ਜਾਵੇ ਧੰਨਵਾਦ